ਹੈਲੋ ਗੁੱਡ ਮੋਰਨਿੰਗ ਸਰ ਮੈਡਮ ਉਹ ਤੁਸੀਂ ਪਰਮਜੀਤ ਐਡਵੋਕੇਟ ਬੋਲ ਰਹੇ ਹੋ ਹਾਂਜੀ ਮੈਡਮ ਤੁਹਾਡੇ ਨਾਲ ਕੰਮ ਸੀ ਤੁਸੀਂ ਵਿਹਲੇ ਹੈ ਇਸ ਟੈਮ ਤੇ ਹਾਂਜੀ ਮੈਡਮ ਅਸੀਂ ਨਾ ਇੱਕ ਪਲਾਟ ਲਿਤਾ ਸੀਗਾ ਅਤੇ ਉਸ ਉਹ ਐਡਵੋਕੇਟ ਉਹ ਨਾ ਬੰਦੇ ਨੇ ਸਾਨੂੰ ਧੋਖਾ ਦੇ ਤਾ ਪ੍ਰੋਪਰਟੀ ਐਡਵਾਈਜ਼ਰ ਨੇ ਸਾਨੂੰ ਧੋਖਾ ਦੇ ਤਾਂ ਕਿ ਉਹ ਪਲਾਟ ਪਹਿਲਾਂ ਹੀ ਕਿਸੇ ਤੋਂ ਵਿਕਿਆ ਹੋਇਆ ਸੀਗਾ ਅਤੇ ਉਹਨੇ ਸਾਨੂੰ ਵੀ ਦੁਬਾਰਾ ਵੇਚਤਾ ਸਾਨੂੰ ਹਾਂਜੀ ਅੰਦਰੋਂ ਅੰਦਰ ਗੱਲ ਪਤਾ ਲੱਗੀ ਹੈ ਵੀ ਸਾਨੂੰ ਅਸੀਂ ਹੁਣ ਉਹਦੇ ਕੋਲ ਜਾ ਕੇ ਪੁੱਛਿਆ ਹੈ ਅਤੇ ਫੇਰ ਉਹ ਮੰਨਦਾ ਨਹੀਂ ਪਿਆ ਇਸ ਗੱਲ ਨੂੰ ਪਰ ਸਾਨੂੰ ਪਤਾ ਲੱਗ ਗਿਆ ਕੀ ਇਹ ਪਹਿਲੇ ਵਿਕਿਆ ਹੋਇਆ ਹੈ ਔਰ ਉਸ ਬੰਦ ਹਾਂਜੀ ਉਸ ਬੰਦੇ ਨੇ ਨਾ ਪਹਿਲੇ ਵੀ ਉਸ 'ਤੇ ਕੇਸ ਕੀਤਾ ਹੋਇਆ ਹਾਂਜੀ ਹਾਂ ਹਾਂਜੀ ਹਾਂਜੀ ਮਦਨ ਨਾਮ ਹੈ ਉਹਦਾ ਅਤੇ ਉਹ ਹਾਂਜੀ ਸਾਡੇ ਇੱਧਰ ਹੀ ਏਰੀਏ ਦੇ ਵਿੱਚ ਹੀ ਰਹਿੰਦਾ ਉਹ ਸਾਨੂੰ ਟਰਸਟ ਸੀਗਾ ਉਹਦੇ ਤੇ ਤਾਂ ਕਰਕੇ ਫਿਰ ਅਸੀਂ ਉਹਦੇ ਅਤੇ ਉਹਦੇ ਕੋਲ ਹੀ ਚਲੇ ਗਏ ਸੀਗੇ ਅਤੇ ਹੁਣ ਨਹੀਂ ਨਹੀਂ ਉਦਾਂ ਲਈ ਤਾਂ ਨਹੀਂ ਨਹੀਂ ਜਾਨ ਪਹਿਚਾਨ 'ਚ ਹੀ ਹਾਂਜੀ ਜਾਨ ਪਹਿਚਾਨ 'ਚ ਹੀ ਸੀਗਾ ਉਹ ਅਸੀਂ ਕਦੇ ਪ੍ਰੋਪਰਟੀ ਲਈ ਨਹੀਂ ਸੀਗੀ ਅਸੀਂ ਚਲ ਜਾਨ ਪਹਿਚਾਨ ਆ ਤਾਂ ਅਸੀਂ ਉਹਦੇ ਤੋਂ ਲੈ ਲਿਆ ਪਰ ਉਹਨੇ ਸਾਨੂੰ ਧੋਖਾ ਦੇ ਤਾ ਹੁਣ ਅਸੀਂ ਰਜਿਸਟਰੀ ਵੀ ਕਰਵਾਤੀ ਉਹਨੇ ਇੱਧਰ ਵੀ ਕਰਵਾਈ ਹੋਈ ਰਜਿਸਟਰੀ ਉੱਧਰ ਵੀ ਕਰਵਾਈ ਹੋਈ ਹੈ ਅਤੇ ਉਹ ਰਜਿਸਟਰੀ ਵੀ ਹਾਂਜੀ ਜਾਲੀ ਹੈ ਉਹ ਉਹ ਉਹਨੇ ਮਤਲਬ ਸਾਨੂੰ ਅਸੀਂ ਉੱਥੇ ਤੱਕ ਗਏ ਸੀਗੇ ਇਹ ਇਕੱਲਾ ਇਕਬਾਲਨਾਮਾ ਕਰਵਾਨ ਉੱਥੇ ਸਾਨੂੰ ਪਤਾ ਲੱਗਿਆ ਕਿ ਇਹ ਤਾਂ ਪਹਿਲੇ ਹੀ ਕਿਸੇ ਦੇ ਨਾਮ 'ਤੇ ਵਿਕੀ ਹੋਈ ਹੈ ਸਾਡੇ ਨਾ ਸਾਡੇ ਇੱਧਰ ਨਹੀਂ ਚੜ੍ਹੀ ਇਹ ਹਾਂਜੀ

ਹਾਂਜੀ ਠੀਕ ਹੈ ਜੀ ਠੀਕ ਹੈ ਜੀ

ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ਠੀਕ ਹੈ ਜੀ ਨਹੀਂ ਨਹੀਂ ਨਹੀਂ ਸਾਨੂੰ ਪਤਾ ਹੀ ਨਹੀਂ ਸੀਗਾ ਪਹਿਲੇ ਅਸੀਂ ਸੋਚਿਆ ਵੀ ਚੱਲ ਬੰਦਾ ਠੀਕ ਆ ਕੋਲ ਰਹਿੰਦਾ ਅਤੇ ਅਸੀਂ ਕਿਹਾ ਚਲ ਵੀ ਇਹਦੇ ਤੋਂ ਹੀ ਲੈ ਲੈ ਲੈਨੇ ਆ ਸਾਨੂੰ ਨਹੀਂ ਪਤਾ ਸੀਗਾ ਵੀ ਉਹ ਵਿੱਚੋਂ ਵਿੱਚ ਧੋਖਾ ਦੇ ਜੂਗਾ ਹਾਂਜੀ ਹਾਂਜੀ ਤੁਹਾਡਾ ਓਫਿਸ ਕਿੱਥੇ ਹੈ ਮੈਮ ਹਾਂਜੀ ਅੱਛਾ ਜੀ ਠੀਕ ਹੈ ਜੀ ਹਾਂਜੀ ਫੀਸ ਕਿੰਨੀ ਹੈ ਫੀਸ ਕਿੰਨੀ ਹੈ ਮੈਡਮ ਆ ਹਾਂਜੀ ਠੀਕ ਹੈ ਧੰਨਵਾਦ ਜੀ